ਭੰਗੜਾ ਐਰੋਬਿਕਸ ਬਾਰੇ ਲੋਕਾਂ ਦੀਆਂ ਸਭ ਤੋਂ ਵੱਡੀਆਂ ਗਲਤਫਹਿਮੀਆਂ ਵਿੱਚੋਂ ਇੱਕ ਹੈ ਹੋ ਸਕਦੀ ਹੈ ਕਿ ਇਹ ਸਿਰਫ਼ ਉੱਚ ਤੀਬਰਤਾ ਵਾਲੀ ਕਸਰਤ ਹੈ ਜਿਸ ਦੀ ਲੋੜ ਹਮੇਸ਼ਾ ਸ਼ਕਤੀਸ਼ਾਲੀ ਅਤੇ ਜ਼ੋਰਦਾਰ ਹੋਣੀ ਚਾਹੀਦੀ ਹੈ ਬਹੁਤ ਸਾਰੇ ਲੋਕ ਇਹ ਸਮਝਦੇ ਹਨ ਕਿ ਇਹ ਸਿਰਫ਼ ਨੱਚਣ ਜਾਂ ਊਂਚ ਉੱਚ ਕੁੱਦਣਾ ਵਾਲੀ ਕਸਰਤ ਹੈ ਪਰ ਅਸਲ ਵਿੱਚ ਇਹ ਹਲਕੀ ਅਤੇ ਨਿਯਮਤ ਤੌਰ 'ਤੇ ਕੀਤੀ ਜਾਣ ਵਾਲੀ ਵਰਜਿਸ਼ ਵੀ ਹੋ ਸਕਦੀ ਹੈ ਇਹ ਇੱਕ ਹੋਰ ਗਲਤਫਹਿਮੀ ਹੈ ਕਿ ਭੰਗੜਾ ਐਰੋਬਿਕਸ ਸਿਰਫ਼ ਨੌਜਵਾਨਾਂ ਜਾਂ ਉੱਚ ਸਿਹਤ ਵਾਲੇ ਲੋਕ ਲਈ ਹੀ ਹੁੰਦਾ ਹੈ ਪਰ ਅਸਲ ਵਿੱਚ ਇਹ ਹਰ ਉਮਰ ਅਤੇ ਹਰ ਲੈਵਲ ਦੇ ਲੋਕਾਂ ਲਈ ਲਾਭਦਾਇਕ ਹੋ ਸਕਦਾ ਹੈ ਇਹ ਹਿਰਦੇ ਦੀ ਸਿਹਤ ਜ਼ਖ਼ਮ ਠੀਕ ਕਰਨ ਅਤੇ ਸਰੀਰ ਦੀ ਫੁਰਤੀ ਵਧਾਉਣ ਵਿੱਚ ਮਦਦ ਕਰ ਸਕਦਾ ਹੈ ਇਸ ਦੇ ਨਾਲ ਨਾਲ ਕੁਛ ਲੋਕ ਇਹ ਵੀ ਸੋਚਦੇ ਹਨ ਕਿ ਐਰੋਬਿਕ ਸਿਰਫ਼ ਦੌੜ ਭੱਜਣ ਜਾਂ ਵਧੀਆ ਫਿਟਨੈਸ ਵਾਲੀ ਲਈ ਹੁੰਦਾ ਹੈ ਪਰ ਅਸਲ ਵਿੱਚ ਇਹ ਆਰਾਮਦਾਇਕ ਅਤੇ ਹੌਲੀ ਹੌਲੀ ਕੀਤੀ ਜਾਣ ਵਾਲੀ ਐਰੋਬਿਕ ਵਰਜਿਸ਼ ਵੀ ਬਹੁਤ ਮਦਦਗਾਰ ਹੋ ਸਕਦੀ ਹੈ ਜੇਕਰ ਤੁਸੀਂ ਲੋਕਾਂ ਨੂੰ ਇਹ ਸਮਝਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਨਾਲ ਸੂਝ ਬੂਝ ਭਰੀ ਗੱਲਬਾਤ ਕਰ ਸਕਦੇ ਹੋ ਉਹਨਾਂ ਨੂੰ ਵਿਗਿਆਨਕ ਤਰੀਕਿਆਂ ਨਾਲ ਦੱਸ ਸਕਦੇ ਹੋ ਕਿ ਭੰਗੜਾ ਐਰੋਬਿਕਸ ਕਿਸ ਤਰੀਕੇ ਨਾਲ ਹਰ ਕਿਸੇ ਲਈ ਲਾਏ ਲਾਭਦਾਇਕ ਹੋ ਸਕਦਾ ਹੈ ਤੁਸੀਂ ਉਦਾਹਰਨ ਦੇ ਕੇ ਦੱਸ ਸਕਦੇ ਹੋ ਕਿ ਕਿਸ ਤਰ੍ਹਾਂ ਹੌਲੀ ਹੌਲੀ ਵਰਜਿਸ਼ ਵੀ ਸਰੀਰ ਲਈ ਉਤਨੀ ਹੀ ਫ਼ਾਇਦੇਮੰਦ ਹੋ ਸਕਦੀ ਹੈ ਜਿੰਨੀ ਕਿ ਉੱਚ ਤੀਬਰਤਾ ਵਾਲੀ ਵਰਜਿਸ਼ ਇਸ ਤਰ੍ਹਾਂ ਤੁਸੀਂ ਲੋਕਾਂ ਦੀਆਂ ਗਲਤ ਫਹਿਮੀਆਂ ਦੂਰ ਕਰ ਸਕਦੇ ਹੋ ਅਤੇ ਉਹਨਾਂ ਨੂੰ ਭੰਗੜਾ ਐਰੋਬਿਕਸ ਦੀ ਅਸਲ ਮਹੱਤਤਾ ਬਾਰੇ ਜਾਣਕਾਰੀ ਦੇ ਸਕਦੇ ਹੋ